ਮੈਂ ਰਮਨਦੀਪ ਤੁਹਾਡੇ ਸਾਰਿਆਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਜਾ ਰਿਹਾ ਜਿਹਦੇ ਵਿੱਚ ਮੈਂ ਆਪਣੀ ਰੂਟੀਨ ਦੇ ਬਾਰੇ ਗੱਲ ਕਰਨ ਜਾ ਰਿਹਾ ਵੀ ਜਿਹੜੇ ਸਾਡੇ ਕੋਚ ਸਾਬ ਆ ਰਣਜੀਤ ਬਾਵਾ ਜੀ ਗੇ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਟ੍ਰੇਨਿੰਗ ਦਿੱਤੀ ਆ ਅਤੇ ਟ੍ਰੇਨਿੰਗ ਦੇ ਦੌਰਾਨ ਜਿਹੜਾ ਵਾ ਉਹਨਾਂ ਨੇ ਸਾਨੂੰ ਬਹੁਤ ਹੀ ਵਧੀਆ ਇੱਕ ਸ਼ੈਡਿਊਲ ਲਿਖ ਕੇ ਦਿੱਤਾ ਵਾ ਜਿਹੜਾ ਅਸੀਂ ਡੇਲੀ ਫੋਲੋ ਕਰਦੇ ਰਹੇ ਹਾਂ ਅਤੇ ਉਹ ਜਿੰਨੇ ਵੀ ਬੱਚੇ ਜਿਹੜੇ ਪਾਰਟੀਸਪੇਟ ਕਰਦੇ ਰਹੇ ਦੌੜਾ ਦੌੜ ਦੇ ਵਿੱਚ ਉਹਨਾਂ ਸਾਰੇ ਯਾਰਾਂ ਨੂੰ ਉਹਨਾਂ ਦੀ ਇਹ ਹੀ ਅਪੀਲ ਮਿਲੀ ਹੈ ਵੀ ਉਹ ਆਪਣਾ ਜਿਹੜਾ ਸ਼ਡਿਊਲ ਵਾ ਇਹਨੂੰ ਜਿਹੜਾ ਵਾ ਉਹ ਡਿਸਿਪਲਨ ਦੇ ਵਿੱਚ ਫੋਲੋ ਕਰੋ ਤਾਂ ਕਿ ਜੇਕਰ ਤੁਹਾਡਾ ਸ਼ਡਿਊਲ ਜੇਕਰ ਤੁਸੀਂ ਫੋਲੋ ਕਰੋਗੇ ਤਾਂ ਤਾ ਤੁਹਾਨੂੰ ਦੌੜ ਦੇ ਵਿੱਚ ਕੋਈ ਜਿਹੜੀ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਆਵੇਗੀ ਉਹ ਸਾਨੂੰ ਸਵੇਰੇ ਸਵਖਤੇ ਪੰਜ ਵਜਦੇ ਰਹੇ ਆ ਅਤੇ ਉਹ ਗਰਾਊਂਡ ਦੇ ਵਿੱਚ ਪੂਰੇ ਟਾਈਮ 'ਤੇ ਪਹੁੰਚ ਜਾਂਦੇ ਰਹੇ ਆ ਟਾਇਮ ਦੇ ਬਹੁਤ ਪਰਵੱਧ ਸੀਗੇ ਅਤੇ ਉਹਨਾਂ ਨੇ ਬੁਲਾ ਕੇ ਸਾਨੂੰ ਜਿਹੜੀਆਂ ਵਾ ਸ਼ੁਰੂ ਤੋਂ ਪਹਿਲਾਂ ਐਕਸਰਸਾਈਜ਼ ਕਰਵਾਉਣੀ ਸ਼ੁਰੂ ਕਰ ਦੇਣੀ ਆ ਪਹਿਲਾਂ ਉਹਨਾਂ ਨੇ ਵਾਰਮ ਅਪ ਕਰਵਾਉਣਾ ਵਾ ਇੱਕ ਦੋ ਚੱਕਰ ਲਗਵਾਉਣੇ ਉਹਨਾਂ ਨੇ ਗਰਾਊਂਡ ਦੇ ਤਾਂ ਕਿ ਜਿਹੜਾ ਸਾਡਾ ਜਿਹੜਾ ਸਰੀਰ ਜਿਹੜਾ ਵਾ ਉਹ ਚੁਸਤ ਫਰੁਸਤ ਹੋ ਜਾਵੇ ਥੋੜ੍ਹਾ ਜਿਹਾ ਥੋੜ੍ਹਾ ਜਿਹਾ ਸਰੀਰ ਦੇ ਵਿੱਚ ਗਰਮਾਹਟ ਆ ਜਾਵੇ ਜਦੋਂ ਗਰਮਾਹਟ ਆ ਜਾਵੇ ਉਸ ਤੋਂ ਬਾਅਦ ਫਿਰ ਨਾਲ ਨਾਲ ਉਹਨਾਂ ਨੇ ਫਿਰ ਐਕਸਰਸਾਈਜਾਂ ਕਰਵਾਉਣੀਆਂ ਥੋੜ੍ਹੀਆਂ ਥੋੜੀਆਂ ਹਲਕੀਆਂ ਹਲਕੀਆਂ ਐਕਸਸਾਈਜ਼ਾ ਕਰਵਾਉਣੀਆਂ ਥੋੜ੍ਹੇ ਬਹੁਤੇ ਜੰਪ ਵਗੈਰਾ ਕਰਵਾਉਣੇ ਆ ਥੋੜ੍ਹੇ ਬਹੁਤੇ ਸਕੋਟਸ ਵਗੈਰਾ ਲਗਵਾਉਣੇ ਸਾਡੇ ਕੋਲ ਤਾਂ ਕਿ ਸਾਡੇ ਜਿਹੜੀਆਂ ਲੱਤਾ ਬਾਹਾਂ ਜਿਹੜੇ ਆ ਜਿਹੜੀਆਂ ਮਸਲੀਆਂ ਬਾਂ ਸਾਡੀਆਂ ਪਸਲੀਆਂ ਜਿਹੜੀਆਂ ਸਰੀਰ ਦੀਆਂ ਉਹ ਥੋੜ੍ਹਾ ਜਿਹਾ ਅੰਗ ਜਿਹੜੇ ਆ ਉਹ ਥੋੜ੍ਹੇ ਖੁੱਲਣ ਅਤੇ ਅਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਉਹ ਆਪਣਾ ਸਰੀਰ ਨੂੰ ਜਿਹੜਾ ਵਾ ਉਹ ਮੇਟੇਨ ਕਰ ਸਕੀਏ ਬਾਕੀ ਖੁਰਾਕ ਦੀ ਗੱਲ ਕਰੀਏ ਤਾਂ ਖੁਰਾਕ ਦੇ ਵਿੱਚ ਉਹ ਸਾਨੂੰ ਕਹਿੰਦੇ ਰਹੇ ਆ ਵੀ ਤੁਸੀਂ ਵਧੀਆ ਦੇਸੀ ਖੁਰਾਕ ਖਾਓ ਪ੍ਰੋਟੀਨ ਵਗੈਰਾ ਨੂੰ ਉਹ ਬਿਲਕੁਲ ਵੀ ਅੱਗੇ ਨਹੀਂ ਲੈ ਕੇ ਜਾਂਦੇ ਰਹੇ ਉਹ ਹਮੇਸ਼ਾ ਇਹ ਹੀ ਕਹਿੰਦੇ ਰਹੇ ਆ ਵੀ ਤੁਸੀਂ ਦੇਸੀ ਦੁੱਧ ਪੀਓ ਕੱਚੇ ਅੰਡੇ ਖਾਓ ਘਰ ਦਾ ਘਰ ਦੀ ਖੁਰਾਕ ਖਾਓ ਦੁੱਧ ਪੀਓ ਦਲੀਆ ਖਾਓ ਵਧੀਆ ਵਧੀਆ ਚੀਜ਼ਾਂ ਖਾਓ ਜਿਹੜੀਆਂ ਮਤਲਬ ਕਿ ਦੇਸੀ ਆ ਮਤਲਬ ਕਿ ਉਹਨਾਂ ਨੇ ਇਹ ਕਦੇ ਵੀ ਪ੍ਰਮੋਟ ਨਹੀਂ ਕੀਤਾ ਵੀ ਆਪਾਂ ਉਹੋ ਜਿਹੀ ਚੀਜ਼ਾਂ ਖਾਣੀਆਂ ਵਾ ਜਿੱਧਰ ਜਿਹੜੀਆਂ ਮਤਲਬ ਕਿ ਮੈਨੁਫੈਕਚਡ ਆਪ ਬਣਵਾਈਆਂ ਹੋਣ ਨੈਚੁਰਲ ਜਿਹੜੀਆਂ ਡਾਇਟ ਡਾਇਟ ਜਿਹੜੀ ਉਹਨੂੰ ਫੋਲੋ ਕਰਨ ਦੇ ਲਈ ਉਹਨਾਂ ਨੇ ਜਿਹੜਾ ਹਮੇਸ਼ਾ ਪ੍ਰੋਤਸਾਹਿਤ ਕੀਤਾ